ਅਸੀਂ ਪੰਜਾਬ ਤੋਂ ਬਲੋਂਗ ਕਰਦੇ ਹਾਂ ਅਤੇ ਸਾਡੇ ਪੰਜਾਬ ਦੇ ਵਿੱਚ ਜ਼ਿਆਦਾਤਰ ਸਿੱਖਾਂ ਦੀ ਗਿਣਤੀ ਹੈ ਔਰ ਸਿੱਖ ਧਰਮ ਦੇ ਵਿੱਚ ਆਪ ਸਭ ਨੂੰ ਪਤਾ ਹੈ ਕਿ ਮੂਰਤੀ ਪੂਜਾ ਲਈ ਕੋਈ ਗੁਰੂ ਸਾਹਿਬਾਨ ਨੇ ਮਤਲਬ ਸਾਨੂੰ ਓਪਸ਼ਨ ਨਹੀਂ ਦਿੱਤੀ ਕਿ ਅਸੀਂ ਮੂਰਤੀ ਪੂਜਾ ਕਰਾਂਗੇ ਸੋ ਇਸ ਕਰਕੇ ਅਸੀਂ ਇਸ ਚੀਜ਼ ਨੂੰ ਇਨਕਾਰ ਕਰਦੇ ਹਾਂ ਕਿ ਸਾਨੂੰ ਅਸੀਂ ਮੂਰਤੀਆਂ ਬਣਾਈਆਂ ਜਾਂ ਅਸੀਂ ਮੂਰਤੀਆਂ ਪੂਜਾ ਕੀਤਾ ਸੋ ਇੱਦਾਂ ਦਾ ਸਾਡਾ ਕੋਈ ਇਕਸਪੀਰੀਅਸ ਨਹੀਂ ਹੈ ਸੋ ਅਸੀਂ ਮੂਰਤੀਆਂ ਨਹੀਂ ਬਣਾਈਆਂ ਕਿਉਂਕਿ ਅਸੀਂ ਮੂਰਤੀ ਪੂਜਕ ਨਹੀਂ ਹਾਂ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਹਾਂ ਐਂਡ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਹਾਂ ਅਤੇ ਗੁਰੂ ਗ੍ਰੰਥ ਸਾਹਿਬ ਸ਼ਬਦ ਗੁਰੂ ਹੈ ਅਤੇ ਸ਼ਬਦ ਗੁਰੂ ਦੇ ਲੜ ਲੱਗੇ ਹਾਂ ਇਸ ਕਰਕੇ ਅਸੀਂ ਮੂਰਤੀ ਕਬਰ ਦੇ ਪੁ ਮੂ ਨਹੀਂ ਮੰਨਦੇ ਹੈਗੇ ਸੋ ਇਸ ਤਰ੍ਹਾਂ ਅਸੀਂ ਮੂਰਤੀ ਪੂਜਕ ਨਹੀਂ ਹਾਂ ਸੋ ਇਸ ਕਰਕੇ ਅਸੀਂ ਮੂਰਤੀਆਂ ਦੀ ਪੂਜਾ ਨਹੀਂ ਕਰਦੇ ਕਿਸੀ ਵੀ ਦੇਵਤਿਆਂ ਦੀ ਅੱਜ ਤੱਕ ਅਸੀਂ ਮੂਰਤੀ ਨਹੀਂ ਬਣਾਈ ਸੋ ਇਹਦੇ ਵਿੱਚ ਸਾਡਾ ਕੋਈ ਅਨੁਭਵ ਨਹੀਂ